ਹੈਲੋ ਹਾਂਜੀ ਹਾਂਜੀ ਜੀ ਅੱਛਾ ਜੀ ਨਹੀਂ ਮੋਹਾਲੀ ਦਾ ਮੌਸਮ ਤਾਂ ਵਧੀਆ ਹੈ ਇਸ ਟਾਈਮ ਪਹਿਲੇ ਸੀਗੀ ਗਰਮੀ ਕਾਫੀ ਲੇਕਿਨ ਹੁਣ ਮੌਸਮ ਠੀਕ ਹੋ ਗਿਆ ਹੈ ਅਤੇ ਸਵੇਰੇ ਸ਼ਾਮ ਦੀ ਠੰਡ ਹੈ ਬਾਕੀ ਦਿਨ 'ਚ ਥੋੜ੍ਹੀ ਗਰਮੀ ਹੁੰਦੀ ਹੈ ਬਾਕੀ ਜੇ ਤੁਸੀਂ ਇੱਥੇ ਕਾਫੀ ਟਾਈਮ ਰਹਿਣਾ ਰੁਕਣਾ ਹੈ ਤਾਂ ਥੋੜ੍ਹੇ ਜਿਹੇ ਗਰਮ ਕੱਪੜੇ ਵੀ ਲੈ ਕੇ ਆਇਓ ਕਿਉਂਕਿ ਹੁਣ ਬਸ ਨੈਕਸਟ ਮੰਨਥ ਤੋਂ ਤਾਂ ਫਿਰ ਥੋੜ੍ਹੀ ਠੰਡ ਸਟਾਰਟ ਹੋ ਜਾਵੇਗੀ ਤੁਹਾਨੂੰ ਪ੍ਰੋਬਲਮ ਹੋਵੇਗੀ ਅਤੇ ਬਾਕੀ ਤੁਸੀਂ ਅਗਰ ਕੋਈ ਮੈਡੀਸਿਨ ਵਗੈਰਾ ਲੈਂਦੇ ਹੋ ਤਾਂ ਆਪਣੀ ਉਹ ਵੀ ਲੈ ਕੇ ਆਇਓ ਕਿਉਂਕਿ ਕਈ ਵਾਰ ਦੂਜੇ ਸਟੇਟ ਦੀ ਮੈਡੀਸਿਨ ਮਿਲਦੀਆਂ ਨਹੀਂ ਹੈਗੀਆਂ ਹਾਂਜੀ ਹਾਂਜੀ ਇੱਥੇ ਦੀ ਸਤਾਰ੍ਹਾਂ ਦੀ ਮਾਰਕੀਟ ਅਤੇ ਤਰਤਾਲੀ ਦੀ ਮਾਰਕੀਟ ਬਹੁਤ ਅੱਛੀਆਂ ਹੈਗੀਆਂ ਨੇ ਤੁਸੀਂ ਉੱਥੇ ਜਾ ਸਕਦੇ ਹਾਂਜੀ ਉਹ ਕੋਈ ਗੱਲ ਨਹੀਂ ਹੈਗੀ ਇੱਥੇ ਹੈਗੀਆਂ ਲੋਕਲ ਮਾਰਕੀਟ ਹੈਗੀਆਂ ਕਾਫੀ ਸਾਰੀਆਂ ਚਾਰ ਫੇਸ ਵਿੱਚ ਵੀ ਹੈਗੀ ਹੈ ਇੱਕ ਵਿੱਚ ਵੀ ਹੈਗੀ ਹੈ ਅਤੇ ਹੋਰ ਥ੍ਰੀ ਬੀ ਟੂ ਵਿੱਚ ਵੀ ਹੈਗੀਆਂ ਨੇ ਅਤੇ ਬਾਕੀ ਜੇ ਤੁਹਾਨੂੰ ਲੱਗੇ ਕਿ ਹਾਂ ਤੁਸੀਂ ਨਹੀਂ ਥੋਨੂੰ ਪਤਾ ਲੱਗ ਰਿਹਾ ਤਾਂ ਤੁਸੀਂ ਮੈਨੂੰ ਕੋਲ ਕਰਕੇ ਮੈਂ ਤੁਹਾਡੇ ਨਾਲ ਚੱਲਾਂਗੀ ਅਤੇ ਤੁਹਾਨੂੰ ਜਿੱਦਾਂ ਵੀ ਠੀਕ ਲੱਗੇ ਹਾਂਜੀ ਨਹੀਂ ਨਹੀਂ ਨਹੀਂ ਤੁਸੀਂ ਹਾਂਜੀ ਹਾਂਜੀ ਮੌਸਮ ਠੀਕ ਹੈ ਹਾਂਜੀ ਓਕੇ ਜੀ ਓਕੇ ਓਕੇ ਜੀ ਓਕੇ